ਮੈਂ ਜਦੋਂ ਪੰਜਵੀਂ ਕਲਾਸ 'ਚ ਸੀਗੀ ਤਾਂ ਮੇਰੀ ਅਧਿਆਪਕ ਨੇ ਮੈਨੂੰ ਪੇਂਟਿੰਗ ਦੀ ਕਲਾਸਾਂ ਹੁੰਦੀਆਂ ਸੀ ਅਤੇ ਸਾਨੂੰ ਕਰਾਉਂਦੇ ਸੀ ਅਤੇ ਮੇਰਾ ਕੁਦਰਤੀ ਬਹੁਤ ਵਧੀਆ ਸੀਗਾ ਪੇਂਟਿੰਗ ਦੇ ਵਿੱਚ ਕਿ ਹਾਂ ਬਹੁਤ ਵਧੀਆ ਮਨ ਹੁੰਦਾ ਸੀਗਾ ਕਿ ਹਾਂ ਵਧੀਆ ਲੱਗਦਾ ਸੀ ਉਹ ਮੈਨੂੰ ਪੇਂਟਿੰਗ ਕਰਨਾ ਜਿਸ ਨਾਲ ਮੇਰੇ ਹੱਥ 'ਚ ਹੋਰ ਸਫਾਈ ਆਈ ਅਤੇ ਮੇਰੀ ਅਧਿਆਪਕ ਨੇ ਮੈਨੂੰ ਕਲਰ ਦੇਣੇ ਮੈਨੂੰ ਇੰਨਾ ਕੁਛ ਸਿਖਾਉਣਾ ਰੋਜ਼ ਜਿਸ ਨਾਲ ਮੇਰੇ ਅੰਦਰ ਦਾ ਕੀ ਕਹਿੰਦੇ ਆ ਕਲਾ ਕਰਨੀ ਕੁਛ ਕਰਨਾ ਅੰਦਰੋਂ ਬਹੁਤ ਜ਼ਿਆਦਾ ਜਾਗ ਗਿਆ ਕਿ ਹਾਂ ਪੇਂਟਿੰਗ ਕਰਨ ਦਾ ਕਲਾ ਜਾਗ ਗਈ ਜਿਸ ਨਾਲ ਮੈਨੂੰ ਬਹੁਤ ਮਦਦ ਮਿਲੀ ਦਸਵੀਂ ਜਮਾਤ ਤੱਕ ਤਾਂ ਮੇਰੀ ਮੈਡਮ ਨੇ ਮੇਰੀ ਬਹੁਤ ਹੈਲਪ ਕੀਤੀ ਫਿਰ ਅੱਗੇ ਜਾ ਕੇ ਮੈਂ ਗਿਆਰਵੀਂ ਅਤੇ ਬਾਰਵੀਂ ਦੇ ਵਿੱਚ ਪੇਂਟਿੰਗ ਦਾ ਇੱਕ ਸਬਜੈਕਟ ਰੱਖਿਆ ਸੀ ਜਿਸ ਨਾਲ ਮੈਨੂੰ ਬਹੁਤ ਜ਼ਿਆਦਾ ਮਦਦ ਹੋਈ ਜਿਸ ਨਾਲ ਮੈਂ ਅੱਗੇ ਜਾ ਕੇ ਕਾਲਜ 'ਚ ਵੀ ਫਿਰ ਰੱਖਿਆ ਮਤਲਬ ਉਹਨਾਂ ਨੇ ਮੈਨੂੰ ਹਮੇਸ਼ਾ ਮੋਟੀਵੇਟ ਕੀਤਾ ਮੇਰੇ ਫੈਮਲੀ ਮੈਂਬਰਜ਼ ਨੇ ਸਭ ਨੇ ਕਿ ਹਾਂ ਬੱਚੇ 'ਚ ਕਲਾ ਹੈਗੀ ਆ ਤਾਂ ਤੁਹਾਨੂੰ ਦਿਖਾਉਣੀ ਚਾਹੀਦੀ ਆ ਸਭ ਨੂੰ ਕਿ ਹਾਂ ਅਸੀਂ ਕਰ ਸਕਦੇ ਹਾਂ ਕਿ ਅਸੀਂ ਬਹੁਤ ਕੁਛ ਬਣਾ ਸਕਦੇ ਹਾਂ ਅਤੇ ਉਹਨਾਂ ਨੇ ਆਲਵੇਜ਼ ਮੈਨੂੰ ਮੋਟੀਵੇਟ ਕੀਤਾ ਹੈ ਕਿ ਕਰਨੀ ਚਾਹੀਦੀ ਆ ਤੁਹਾਨੂੰ ਪੇਂਟਿੰਗ